ਮੈਂ ਇਹ ਬੋਟ ਦਾ ਸਪੀਕਰ ਔਡਰ ਕੀਤਾ ਸੀ ਔਨਲਾਈਨ ਇਹ ਸਪੀਕਰ ਦੀ ਪ੍ਰਾਈਸ ਸੀਗੀ ਤੇਰ੍ਹਾਂ ਸੌ ਰੁਪਏ ਤੇਰ੍ਹਾਂ ਸੌ ਰੁਪਏ ਦਾ ਔਡਰ ਕੀਤਾ ਸੀ ਅਤੇ ਮੈਨੂੰ ਇਹ ਦੂਸਰੇ ਦਿਨ ਹੀ ਪ੍ਰਾਪਤ ਹੋ ਗਿਆ ਸੀਗਾ ਅਤੇ ਜਦੋਂ ਮੈਂ ਇਸ ਦੇ ਉੱਪਰ ਆਪਣਾ ਮਿਊਜ਼ਿਕ ਲਗਾਇਆ ਅਤੇ ਉਹ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਿਹੜੀ ਵੋਇਸ ਸੀਗੀ ਉਹ ਵੀ ਬੜੀ ਵਧੀਆ ਆ ਰਹੀ ਸੀਗੀ ਤੇ ਟ੍ਰੀਬਲ ਸਾਊਂਡ ਬਹੁਤ ਅੱਛੀ ਹੈ ਇਹਦੇ ਵਿੱਚ ਗਾਣੇ ਅਤੇ ਸ਼ਬਦ ਬਹੁਤ ਵਧੀਆ ਚੱਲਦੇ ਨੇ ਆਵਾਜ਼ ਬਿਲਕੁਲ ਐ ਲੱਗਦਾ ਜਿਵੇਂ ਕਿ ਆਪਾਂ ਨਾ ਸਾਹਮਣੇ ਬੈਠੇ ਸੁਣ ਰਹੇ ਹੋਈਏ ਇੰਨੀ ਵਧੀਆ ਆਵਾਜ਼ ਆਉਂਦੀ ਆ ਇਹਦੇ ਵਿੱਚ ਕੋਈ ਵੀ ਡਿਸਟਰਬੈਂਸ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਸੁਣਦੇ ਹਾਂ ਐਨ ਪੂਰੀ ਪੂਰੀ ਕਲੈਰਟੀ ਦੀ ਆਵਾਜ਼ ਆ ਰਹੀ ਆ ਮੈਨੂੰ ਪਹਿਲਾਂ ਸੀ ਵੀ ਇਹ ਛੋਟਾ ਜਿਹਾ ਸਪੀਕਰ ਕੀ ਕੰਮ ਕਰੂਗਾ ਵੀ ਸਪੀਕਰ ਦੇ ਸਾਈਜ਼ ਤੋਂ ਨਹੀਂ ਪਤਾ ਲੱਗਦਾ ਕਿ ਉਹ ਕਿੰਨੀ ਵਧੀਆ ਅਤੇ ਉੱਚੀ ਆਵਾਜ਼ ਦਿੰਦਾ ਬਟ ਇਹਦੀ ਆਵਾਜ਼ ਉੱਚੀ ਵੀ ਆ ਅਤੇ ਕਲੀਅਰ ਵੀ ਆ ਅਤੇ ਦੂਰ ਤੱਕ ਸੁਣਦੀ ਆ ਐਂਨ ਬਿਲਕੁਲ ਕਲੀਅਰ ਹਰ ਇੱਕ ਜਿਹੜਾ ਇੰਸਟਰੂਮੈਂਟ ਕੋਈ ਵੀ ਸਾਜ ਵੱਜ ਰਿਹਾ ਉਹਦੀ ਜਿਹੜੀ ਆਵਾਜ਼ ਆ ਅਲੱਗ ਐਕਸਪੀਰੀਐਂਸ ਦਿੰਦੀ ਆ ਸਾਊਂਡ ਸਾਊਂਡ ਵਾਂਗੂੰ ਜਿਵੇਂ ਨਾ ਸਾਰਾ ਕਮਰਾ ਗੂੰਜ ਰਿਹਾ ਹੋਵੇ ਉਸ ਤਰ੍ਹਾਂ ਦੀ ਆਵਾਜ਼ ਆਉਂਦੀ ਆ ਅਤੇ ਇੱਕ ਜਿਹੜਾ ਇਹਦਾ ਲੋਗੋ ਵੀ ਮੈਨੂੰ ਬਹੁਤ ਪਸੰਦ ਆ ਉੱਪਰ ਜਿਹੜਾ ਲਿਖਿਆ ਹੋਇਆ ਬੋਟ ਉਹਦੇ ਵਿੱਚ ਇੱਕ ਛੋਟੀ ਜਿਹੀ ਕਿਸ਼ਤੀ ਵੀ ਬਣੀ ਹੋਈ ਆ ਓਵਰਆਲ ਲੁਕ ਵੀ ਅੱਛੀ ਹੈ ਡਸਟ ਪਰੂਫ ਹੈ ਕਿਉਂਕਿ ਕਾਫੀ ਦੇਰ ਹੋ ਗਈ ਮੈਨੂੰ ਇਹਨੂੰ ਯੂਜ਼ ਕਰਦੇ ਹੋਏ ਉੱਪਰ ਕੋਈ ਡਸਟ ਵਗੈਰਾ ਦਾ ਕੋਈ ਨਿਸ਼ਾਨ ਨਹੀਂ ਹੈ ਪੂ ਪੂਰਾ ਓਵਰਆਲ ਐਕਸਪੀਰੀਅੰਸ ਜਿਹੜਾ ਮੇਰਾ ਵਧੀਆ ਰਿਹਾ ਇਸ ਪ੍ਰੋਡਕਟ ਦੇ ਨਾਲ ਅਤੇ ਜਿਹੜੇ ਮੇਰੇ ਦੋਸਤ ਨੇ ਉਹ ਵੀ ਇਹ ਪ੍ਰੋਡਕਟ ਖਰੀਦਣਾ ਚਾਹੁੰਦੇ ਨੇ ਅਤੇ ਮੈਂ ਰਿਕਮੈਂਡ ਵੀ ਕੀਤਾ ਉਹਨਾਂ ਨੂੰ ਇਸ ਬਾਰੇ